ਅਸੀਂ ਰੋਜ਼ਾਨਾ ਜੀਵਨ ਵਿੱਚ ਆਪਣੀਆਂ ਡਰਾਇੰਗਾਂ ਲਈ ਪ੍ਰੇਰਨਾ ਪ੍ਰਾਪਤ ਕਰਦੇ ਹਾਂ ਜਿਸ ਤਰ੍ਹਾਂ ਕਿ ਜੀਵਨ ਤੋਂ ਡਰਾਇੰਗ ਜੀਵਨ ਤੋਂ ਡਰਾਇੰਗ ਅਸੀਂ ਆਪਣੇ ਆਲੇ ਦੁਆਲੇ ਦੇ ਦ੍ਰਿਸ਼ ਨੂੰ ਦੇਖ ਕੇ ਰੁੱਖ ਪੌਦੇ ਹਵਾ ਦਾ ਦ੍ਰਿਸ਼ ਦੇਖ ਕੇ ਅਸੀਂ ਕਰ ਸਕਦੇ ਹਾਂ ਇੱਕ ਕਾਗਜ਼ 'ਤੇ ਦਰਸ਼ਾ ਸਕਦੇ ਹਾਂ ਮੈਂ ਵੀ ਅਠਵੀਂ ਸ਼੍ਰੇਣੀ ਵਿੱਚ ਇੱਕ ਜ਼ੋਰਦਾਰ ਹਵਾ ਚਲਦੀ ਸੀ ਉਸਨੂੰ ਇੱਕ ਕਾਗਜ਼ 'ਤੇ ਅੰਕਿਤ ਕੀਤਾ ਪਾਣੀ ਵਿੱਚ ਤੈਰਦੀ ਹੋਈ ਕਿਸ਼ਤੀ ਨੂੰ ਅਸੀਂ ਡਰਾਇੰਗ ਵਿੱਚ ਵੱਖਰੇ ਵੱਖਰੇ ਰੰਗਾਂ ਨਾਲ ਇੱਕ ਤੋਂ ਵੱਧ ਕਿਸ਼ਤੀਆਂ ਵੀ ਬਣਾ ਸਕਦੇ ਹਾਂ ਰੰਗਾਂ ਨਾਲ ਉਸਨੂੰ ਆਪਣੇ ਵੱਲੋਂ ਦ੍ਰਿਸ਼ ਬਣਾ ਸਕਦੇ ਹਾਂ ਰੁੱਖ ਸਾਡੇ ਨਾਲ ਨਾਲ ਚੱਲਦੇ ਹਨ ਅਸੀਂ ਕਿਸੇ ਜਗ੍ਹਾ 'ਤੇ ਜਾਣਦੇ ਹੋਏ ਇਹ ਦੇਖਦੇ ਹਾਂ ਅਸਮਾਨ ਦਾ ਦ੍ਰਿਸ਼ ਦਰਸ਼ਾ ਸਕਦੇ ਹਾਂ ਸ਼ਾਮ ਨੂੰ ਸੂਰਜ ਛਿਪ ਰਿਹਾ ਹੋਵੇ ਅਸੀਂ ਰੰਗਾਂ ਨਾਲ ਡਰਾਇੰਗ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਉਦਾਹਰਨ ਦੇ ਤੌਰ 'ਤੇ ਘਰ ਦੇ ਕੋਲ ਚਾਰ ਮਕਾਨ ਹਨ ਸਾਹਮਣੇ ਗਰਾਊਂਡ ਹੈ ਗਰਾਊਂਡ ਵਿੱਚ ਅੰਬ ਦਾ ਰੁੱਖ ਹੈ ਗੱਡੀ ਖੜ੍ਹੀ ਹੈ ਆਲੇ ਦੁਆਲੇ ਲੰਘਣ ਵਾਲਿਆਂ ਲਈ ਰਸਤਾ ਹੈ ਕਲਪਨਾ ਤੋਂ ਡਰਾਇੰਗ ਅਸੀਂ ਆਪਣੀ ਕਲਪਨਾ ਜੋ ਸਾਡੇ ਮਨ ਅੰਦਰ ਸੋਚ ਹੈ ਉਸ ਦੇ ਆਧਾਰ 'ਤੇ ਬਣਾਉਂਦੇ ਹਾਂ ਜਿਵੇਂ ਕਿ ਨਦੀ ਦੇ ਕਿਨਾਰੇ ਇੱਕ ਘਰ ਹੈ ਕੋਲ ਇੱਕ ਰੁੱਖ 'ਤੇ ਪੰਛੀਆਂ ਦਾ ਆਲਣਾ ਹੈ ਨਾਲ ਹੀ ਝਰਨਾ ਵਗ ਰਿਹਾ ਹੈ ਆਸ ਪਾਸ ਖੇਤ ਹੀ ਖੇਤ ਹਨ ਨਦੀ ਦਾ ਪਾਣੀ ਸ਼ਾਂਤ ਹੈ ਘਰ ਦੇ ਬਾਹਰ ਇੱਕ ਬ ਪਾਸੇ ਬੱਚੇ ਖੇਡ ਰਹੇ ਹਨ ਇਸ ਤਰ੍ਹਾਂ ਦਾ ਕਾਲਪਨਿਕ ਦ੍ਰਿਸ਼ ਅਸੀਂ ਬਣਾ ਸਕਦੇ ਹਾਂ